ਅੱਜ ਦੇ ਟਾਈਮ ਦੇ ਵਿੱਚ ਫੋਟੋਗ੍ਰਾਫੀ ਦੇ ਵਿੱਚ ਬਹੁਤ ਬਦਲਾਵ ਆ ਗਿਆ ਆ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੈਮਰੇ ਹੁੰਦੇ ਸੀ ਉਹਨਾਂ ਨੂੰ ਅਸੀਂ ਫੋਟ ਕ ਉਹਦੇ ਵਿੱਚ ਰੀਲਸ ਪੈਂਦੀ ਸੀ ਔਰ ਉਹ ਫੋਟੋ ਖਿੱਚ ਕੇ ਉਹਨੂੰ ਧਵਾਇਆ ਜਾਂਦਾ ਸੀ ਔਰ ਦੋ ਤਿੰਨ ਚਾਰ ਹਫਤਾ ਮਹੀਨਿਆਂ ਦੇ ਵਿੱਚ ਉਹ ਸਾਨੂੰ ਸਾਡੀਆਂ ਫੋਟੋਆਂ ਸਾਨੂੰ ਮਿਲਦੀਆਂ ਸਨ ਅੱਜ ਦੇ ਟਾਈਮ ਦੇ ਵਿੱਚ ਮੋਬਾਇਲ ਕੈਮਰਿਆਂ ਦੇ ਨਵੇਂ ਨਵੇਂ ਉਪਕਰਨ ਆ ਗਏ ਉਹ ਹਰ ਇੱਕ ਨਵੀਂ ਫੈਸਿਲਿਟੀ ਹਰ ਇੱਕ ਨਵੇਂ ਮੋਬਾਇਲ ਦੇ ਵਿੱਚ ਮਿਲ ਰਹੀ ਆ ਜਿਵੇਂ ਗੱਲ ਕਰੀਏ ਕਿ ਕਲੀਅਰਟੀ ਦੀ ਅਤੇ ਮੋਬਾਇਲ ਅੱਜ ਕੱਲ੍ਹ ਇੱਦਾਂ ਦੇ ਹਨ ਜਿਹਦੇ ਵਿੱਚ ਸਾਡੀ ਪਿਕਚਰ ਬਹੁਤ ਹੀ ਵਧੀਆ ਆ ਜਾਂਦੀ ਹੈ ਇਹਦੇ ਵਿੱਚ ਫਿਲਟਰਸ ਵਗੈਰਾ ਆ ਗਿਆ ਹੈ ਜਿਹਦੇ ਵਿੱਚ ਸਾਡੇ ਚਿਹਰੇ ਦੇ ਦਾਗ ਧੱਬੇ ਵਗੈਰਾ ਸਾਨੂੰ ਸਾਡੇ ਇਕਦਮ ਸਾਫ ਦਿਖਾ ਸਾਫ ਹੋ ਜਾਂਦੇ ਹਨ ਔਰ ਸਾਡੀ ਫੋਟੋ ਬਹੁਤ ਹੀ ਵਧੀਆ ਤਰੀਕੇ ਨੇ ਦਿਖਾਈ ਜਾਂਦੀ ਹੈ ਔਰ ਇਹਦੇ ਵਿੱਚ ਸਾਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਕਿਉਂਕਿ ਅਸੀਂ ਜੇ ਜਦ ਫੋਟੋ ਖਿੱਚੀਏ ਔਰ ਉਹ ਫੋਟੋ ਨੂੰ ਅਸੀਂ ਉਸੇ ਵੇਲੇ ਖਿੱਚ ਕੇ ਕਿਤੇ ਵੀ ਉਹਨੂੰ ਅਸੀਂ ਸੈਂਡ ਕਰਕੇ ਕਿਸੇ ਨੂੰ ਵੀ ਭੇਜ ਸਕਦੇ ਹਨ ਔਰ ਪੁਰਾਣੇ ਟਾਈਮ ਦੇ ਵਿੱਚ ਇਹ ਹੁੰਦਾ ਸੀਗਾ ਕਿ ਜਿਹੜੀਆਂ ਫੋਟੋਆਂ ਸੀਗੀਆਂ ਉਹਨੂੰ ਸਮਾਂ ਜ਼ਿਆਦਾ ਲੱਗਦਾ ਸੀ ਔਰ ਹੁਣ ਦੇ ਟਾਈਮ ਦੇ ਵਿੱਚ ਮੋਬਾਇਲ ਕੈਮਰੇ ਦੇ ਨਾਲ ਨਾਲ ਹੁਣ ਦੇ ਕੈਮਰੇ ਵੀ ਇੱਦਾਂ ਦੇ ਬਣ ਗਏ ਹਨ ਜਿਹੜੇ ਕਿ ਸਾਨੂੰ ਛੇਤੀ ਤੋਂ ਛੇਤੀ ਉਸੇ ਦੇ ਉਸੇ ਵੇਲੇ ਹੀ ਸਾਨੂੰ ਇਹ ਫੋਟੋ ਦੇ ਦਿੰਦੇ ਹਨ